ਸਤਿ ਸ਼੍ਰੀ ਅਕਾਲ ਸਰ ਕੀ ਮੈਂ ਫਿਲਿਪਕਾਰਡ ਦੇ ਮੈਨੇਜਰ ਨਾਲ ਗੱਲ ਕਰ ਰਹੀ ਹਾਂ ਹਾਂਜੀ ਸਰ ਇਹ ਤੁਸੀਂ ਮੈਨ ਕਿਉਂਕਿ ਮੈਂ ਇੱਕ ਫਲਿਪਕਾਰਡ ਤੋਂ ਪੇਂਟ ਔਡਰ ਕੀਤੇ ਸੀ ਹਾਂਜੀ ਹਾਂਜੀ ਸਰ ਉਹਦੇ ਨਾਲ ਹੁਣ ਪ੍ਰੋਬਲਮ ਖ਼ਰਾਬੀਆਂ ਆ ਰਹੀਆਂ ਨੇ ਕਿਉਂਕਿ ਉਹ ਜੋ ਵੀ ਉਹ ਆਪਾਂ ਜੋ ਵੀ ਪੇਂਟ ਕਰ ਰਹੇ ਹਾਂ ਆਪਾਂ ਦੀਵਾਰ ਨੂੰ ਪੇਂਟ ਕਰ ਰਹੇ ਹਾਂ ਸਾਡੇ ਸਕਿੰਨ 'ਤੇ ਜੇ ਜੇ ਲੱਗ ਜਾਏ ਤਾਂ ਉਹ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ ਹਰ ਇੱਕ ਤਰੀਕੇ ਦੀ ਖ਼ਰਾਬੀ ਕਰ ਸਕਿੰਨ ਪ੍ਰੋਬਲਮ ਸਮੈੱਲ ਸਮੈੱਲ ਬਹੁਤ ਗੰਦੀ ਆ ਰਹੀ ਆ ਉਹਦੀ ਹਾਂਜੀ ਸਰ ਫ਼੍ਰੈੱਸ਼ ਨਹੀਂ ਹੈ ਵੋ ਫ੍ਰੈੱਸ਼ ਪੇਂਟ ਨਹੀਂ ਹੈ ਪ੍ਰੋਬਲਮ ਕ੍ਰੀਏਟ ਕਰ ਰਹੇ ਐਕਸਪਾਇਰਡ ਹੈ ਹਾਂਜੀ ਸਰ ਇਹਦੇ ਕਰਕੇ ਸਾ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਹੱਥ 'ਤੇ ਰੈਸ਼ਿਸ਼ ਹੋ ਰਹੇ ਨੇ ਹਾਂਜੀ ਸਰ ਕੀ ਤੁਸੀਂ ਇਸ ਚੀਜ਼ ਨੂੰ ਰਿਫੰਡ ਕਰ ਸਕਦੇ ਹੋ ਇਹਦੇ ਕਰਕੇ ਕੰਮ 'ਚ ਖ਼ਰਾਬੀ ਹੋ ਰਹੀ ਹੈ ਹਾਂਜੀ ਸਰ ਤੁਸੀਂ ਮੈਨੂੰ ਇਹ ਤੁਸੀਂ ਮੈਨੂੰ ਇਹ ਦੱਸ ਸਕਦੇ ਹੋ ਕਿੱਦਾਂ ਇਹਦ ਇਹਦੀ ਤੁਸੀਂ ਇਸ ਚੀਜ਼ ਨੂੰ ਰਿਫੰਡ ਕਰੋਗੇ ਕਿ ਇਸ ਚੀਜ਼ ਨੂੰ ਐਕਸਚੇਂਜ ਪਾਓਗੇ ਐਕਸਚੇਂਜ ਮੈਂ ਨਹੀਂ ਕਰ ਸਕਦੀ ਠੀਕ ਹੈ ਸਰ ਹਾਂਜੀ ਸਰ